ਸ਼ਹੀਦ ਭਗਤ ਸਿੰਘ ਨਗਰ ਵਿੱਚ ਕਾਫੀ ਸਾਰੇ ਪ੍ਰਾਈਵੇਟ ਅਤੇ ਸਿਖ ਸਰਕਾਰੀ ਸਿੱਖਿਅਕ ਅਦਾਰੇ ਹੈਗੇ ਨੇ ਜਿਹਦੇ ਵਿੱਚ ਮੈਂ ਅਗਰ ਗੱਲ ਕਰਾਂ ਸਕੂਲਾਂ ਦੀ ਤਾਂ ਇਹਦੇ ਵਿੱਚ ਕਾਫੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਹਨ ਜਿਸ ਤਰ੍ਹਾਂ ਕੇ ਸੀ ਪਬਲਿਕ ਸਕੂਲ ਟੈਗੋਰ ਮੋਡਲ ਸਕੂਲ ਡੀ ਏ ਵੀ ਪਬਲਿਕ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਡ ਰੋ ਸਕੂਲ ਕੈਂਬਰਿਜ ਸਕੂਲ ਮਾਊਂਟ ਸੈਂਟਸ ਜੋਸਫ਼ ਸਕੂਲ ਔਰ ਇਹਨਾਂ ਸਾਰੇ ਵਿੱਦਿਅਕ ਅਦਾਰਿਆਂ 'ਚ ਬਹੁਤ ਅੱਛੀ ਸਿਕਸ਼ਾ ਪ੍ਰਦਾਨ ਕੀਤੀ ਜਾਂਦੀ ਹੈ ਅਗਰ ਮੈਂ ਕੋਲਜ ਦੀ ਗੱਲ ਕਰਾਂ ਤਾਂ ਇੱਥੇ ਕਾਫੀ ਸਾਰੇ ਕੋਲਜ ਵੀ ਹਨ ਜਿਹੜੇ ਕਿ ਜਿਹਨਾਂ ਵਿੱਚ ਪ੍ਰਮੁੱਖ ਹੈ ਕੇ ਸੀ ਗਰੁੱਪ ਔਫ ਇੰਸਚੀਟਿਊਸ਼ਨ ਆਰ ਕੇ ਆਰੀਆ ਕੋਲਜ ਬੀ ਬੀ ਐੱਲ ਐੱਮ ਕੋਲਜ ਜਿਨ੍ਹਾਂ ਵਿੱਚ ਕਾਫੀ ਸਹੀ ਫੀਸ 'ਤੇ ਵਿਦਿਆਰਥੀਆਂ ਨੂੰ ਸਿਕਸ਼ਾ ਪ੍ਰਦਾਨ ਕੀਤੀ ਜਾਂਦੀ ਹੈ ਅੱਜ ਕੱਲ੍ਹ ਦੇ ਮੈਂ ਵਿਦਿਆਰਥੀਆਂ ਨੂੰ ਜ਼ਿਆਦਾਤਰ ਦੇਖਿਆ ਕਿ ਉਹਨਾਂ ਨੂੰ ਸਕਿੱਲ ਬੇਸਡ ਕੋਰਸ ਲੈਣ 'ਚ ਜ਼ਿਆਦਾ ਉਹ ਦਿਲਚਸਪੀ ਰੱਖਦੇ ਹਨ